ਸਾਡੇ ਫਤਿਹਗੜ੍ਹ ਜ਼ਿਲ੍ਹੇ ਵਿੱਚ ਕਈ ਲਾਇਬ੍ਰੇਰੀਆਂ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਲਾਇਬ੍ਰੇਰੀ ਜੋ ਸਰਕਾਰ ਵੱਲੋਂ ਬਣਾਈ ਗਈ ਹੈ ਅਕਸਰ ਅਸੀਂ ਉਸ ਵਿੱਚ ਜਾਂਦੇ ਹਾਂ ਅਤੇ ਸ਼ਨੀਵਾਰ ਐਤਵਾਰ ਸਾਨੂੰ ਛੁੱਟੀ ਹੁੰਦੀ ਹੈ ਅਸੀਂ ਅਕਸਰ ਉੱਥੇ ਕਿਤਾਬਾਂ ਪੜ੍ਹਨ ਜਾਂਦੇ ਹਾਂ ਜਿਨ੍ਹਾਂ ਵਿੱਚੋਂ ਅਸੀਂ ਕਈ ਤਰ੍ਹਾਂ ਦੇ ਨਾਵਲ ਮੈਂ ਹੁਣ ਤੱਕ ਪੜ੍ਹ ਚੁੱਕਿਆ ਹਾਂ ਜਿਵੇਂ ਕਿ ਲਿਓਟਾਸਾ ਜਾਂ ਸ੍ਰੇਸ਼ਠ ਕਹਾਣੀਆਂ ਨਾਵਲ ਹੋਇਆ ਸੱਚ 'ਤੇ ਫਾਂਸੀ ਨੂੰ ਨਾਵਲ ਸੱਚ ਬੋਲੋ ਜ਼ਿੰਦਗੀ ਬਦਲੋ ਨਾਵਲ ਹੋਇਆ ਹਿਟਲਰ ਦੀ ਸਵੈ ਜੀਵਨੀ ਪਹਿਲਾ ਅਧਿਆਪਕ ਮੇਰਾ ਦਰਗਿਸਤਾਨ ਨਾਵਲ ਗੌਤਮ ਤੋਂ ਤਾਸਕੀ ਇੱਕ ਦੇਸ਼ ਦਾ ਜਨਮ ਪ੍ਰਾਚਿਤ ਮਿੱਠਾ ਮਹੁਰਾ ਲੰਮਾ ਪੈਂਡਾ ਆਦਿ ਨਾਵਲ ਹੁਣ ਤੱਕ ਮੈਂ ਪੜ੍ਹ ਚੁੱਕਿਆ ਹਾਂ ਉਸ ਤੋਂ ਬਾਅਦ ਹੁਣ ਵੀ ਮੇਰੀ ਅੱਗੇ ਤੋਂ ਇਹੀ ਕੋਸ਼ਿਸ਼ ਹੋਈ ਵੀ ਜਿੰਨਾ ਤੋਂ ਵੱਧ ਤੋਂ ਵੱਧ ਹੋ ਸਕੇ ਮੈਂ ਨਾਵਲ ਪੜ੍ਹ ਸਕਾਂ ਅਤੇ ਮੈਂ ਹੁਣ ਭਗਤ ਸਿੰਘ ਦੀ ਜੀਵਨੀ ਸ਼ੁਰੂ ਕੀਤੀ ਹੈ ਜੋ ਅੱਧ ਤੋਂ ਵੱਧ ਪੜ੍ਹ ਚੁੱਕਾ ਹਾਂ ਅਤੇ ਮੈਂ ਹੁਣ ਕਈ ਵਿੱਚ ਕਤ ਕਵਿਤਾਵਾਂ ਵੀ ਪੜ੍ਹਦੇ ਹਾਂ ਜਿਹਦੇ ਵਿੱਚ ਇਨਕਲਾਬੀ ਕਵੀ ਪਾਰਸ ਦੀਆਂ ਕਿਤਾਬਾਂ ਜਾਂ ਕਵਿਤਾਵਾਂ ਜ਼ਿਆਦਾਤਰ ਹਨ ਜੋ ਕਿ ਹਰ ਇੱਕ ਨੂੰ ਪਸੰਦ ਹਨ